ਕਿਦਾ ਹਾਂ ਸਾਗਰ ਕਿਦਾਂ ਕੀ ਕਰਦਾ ਪਿਆ ਮੈਂ ਨੌਕਰੀ ਬਾਰੇ ਲੱਭਦਾ ਸੀਗਾ ਪਰ ਸਮਝ ਨਹੀਂ ਆਉਂਦਾ ਕੀ ਕਿੱਥੇ ਅਪਲਾਈ ਕਰਾਂ ਹਾਂ

ਹਾਂ ਉਦਾਂ ਦਾ ਮੈਨੂੰ ਆਈ ਟੀ ਡਿਜੀਟਲ ਮਾਰਕੀਟਿੰਗ ਨੌਲੇਜ ਹੈਗੀ ਆ

ਕੋਈ ਲੱਭਦਾ ਕੋਈ ਮਿਲ ਜੇ ਜੋਬ ਹਾਂ ਕੀ ਕਹਿੰਦਾ ਆਵਾਜ ਨੀ ਆਈ ਹਾਂ ਉਥੇ ਤਾਂ ਘੰਟਾ ਹੋ ਗਿਆ ਹਾਂ ਉਹ ਪੀਛੇ ਮਾਲ ਖਰਾਬ ਆਏ ਉਹ ਪਿੱਛੇ ਖਰਾਬ ਮਾਲਾ ਸੀ ਨਾ ਤੇ ਉਹਨਾਂ ਦਾ ਰੇਟ ਵੀ

ਹਾਂ ਘੰਟਾ ਜਿਹਾ ਹੋ ਗਿਆ ਸੀਗਾ ਕਿੱਥੇ ਆ ਕਿੱਥੇ ਲਾਉਂਦਾ ਸੀ

ਅੱਛਾ ਤੇ ਹੁਣ ਹੁਣ ਵੀ ਉਹ ਹੀ ਲਾਉਂਦਾ ਪਿਆ ਅੱਛਾ ਮੈਂ ਤਾਂ ਕੋਈ ਜੋਬ ਲੱਗ ਰਿਹਾ ਸੀਗਾ ਜੋਬ ਲਾਭਦਾ ਸੀ ਉਥੇ ਲੈ ਵੀ ਕੰਮ ਕਰਨ ਆਪਣਾ ਕੰਮ ਬਾਅਦ 'ਚ ਦੇਖਦੇ ਕੁਛ ਹਾਂ ਉਥੋਂ ਵੀ ਹਾਂ ਉਥੋਂ ਵੀ ਛੱਡਣਾ ਨਹੀਂ ਨਹੀਂ ਸੈਲਰੀ ਬਹੁਤ ਘੱਟ ਹੈ ਇਥੇ ਕੰਮ ਬਹੁਤ ਜਿਆਦਾ ਕਰਵਾਉਂਦੇ ਇਥੇ ਹਾਂ ਇਥੇ ਬੰਦੇ ਹੈ ਨੀ ਚਾਜਦੇ

ਅਛਾ ਦੱਸਿਆ ਨੀ ਆ ਦੇਖਦੇ ਆ ਅੱਛਾ ਹਾਂ ਇਦਾਂ ਹੀ ਚਲਦਾ ਇਥੇ ਤਾਂ ਦੇਖਦੇ ਆ ਇੱਕ ਯੂਟੀਊਬ ਖੁੱਲਿਆ ਹੋਸ਼ਿਆਰਪੁਰ ਚ ਉਥੇ ਅੱਛਾ ਕੋਈ ਨਾ ਜੇ ਪਤਾ ਲੱਗਿਆ ਫਿਰ ਦੱਸੀ ਓਕੇ ਚੱਲ ਮਿਲਦੇ ਆ ਫਿਰ

ਮੈਂ ਦੱਸਦਾ ਤੈਨੂੰ ਤੇਰੇ ਸ਼ਹਿਰ ਮਿਲਦੇ ਹਾਂ ਕਿੱਥੇ ਆ ਤੂੰ ਮੈਂ ਵੀਹ ਕ ਮਿੰਟ ਚ ਠੀਕ ਆ ਓਕੇ ਠੀਕ ਹੈ ਰੱਖਦਾ ਮੈ